ਬਾਲੀਵੁੱਡ ਅਤੇ ਟਾਲੀਵੁੱਡ ਦੇ ਵਿੱਚ ਜਿਹੜਾ ਫੈਸ਼ਨ ਹੈ ਉਹ ਚੱਲਦਾ ਜਾ ਰਿਹਾ ਉਹ ਚੱਲੀ ਜਾਵੇਗਾ ਪਰੰਤੂ ਮੈਂ ਇਹਨਾਂ ਦੇ ਨਾਲ ਕੋਈ ਸੰਬੰਧ ਨਹੀਂ ਰੱਖਦਾ ਮੈਂ ਪੰਜਾਬੀ ਫਿਲਮਾਂ ਜ਼ਰੂਰ ਦੇਖਦਾ ਹਾਂ ਅਤੇ ਮੈਂ ਉਹਨਾਂ ਪੰਜਾਬੀ ਫਿਲਮਾਂ ਨੂੰ ਹੀ ਦੇਖ ਕੇ ਜੋ ਵੀ ਪ ਪਹਿਰਾਵਾ ਵੈ ਉਹ ਪਸੰਦ ਕਰਦਾ ਹਾਂ